ਹੈਲੋ ਹਾਂਜੀ ਹਾਂਜੀ ਹਾਂਜੀ ਬੋਲੋ ਹਾਂਜੀ ਇ ਇੱਥੋਂ ਸ ਸਭ ਤੋਂ ਵਧੀਆ ਮਿਲਣੀ ਹੈ ਤੋ ਤੁਹਾਨੂੰ ਤੋਂ ਅਨੰਦਪੁਰ ਸਾਹਿਬ ਚੰਡੀਗੜ੍ਹ ਮੋਲ ਉੱਥੇ ਹੀ ਮਿਲੂੰਗੀ ਵੀ ਤੁਹਾਨੂੰ ਸਭ ਤੋਂ ਵਧੀਆ ਵਧੀਆ ਹਾਂਜੀ ਇਹ ਤੋਂ ਥਰਟੀ ਏਟ ਕਿਲੋਮੀਟਰ ਹੋਣੇ ਹੈ ਜਾਂ ਫਿਰ ਸ ਤੋਂ ਵੱਧ ਵੀ ਹੋ ਸਕਦਾ ਹੈ ਹਾਂਜੀ ਔਰ ਦ ਔਰ ਪੁੱਛੋ ਪ੍ਰਾਈਜ਼ ਪ੍ਰਾਈਜ਼ ਬਹੁਤ ਸਸਤੀ ਪ੍ਰਾਈਜ਼ ਵੀ ਮਿਲ ਜਾਂਦੀ ਹੈ ਵਧੀਆ ਵਧੀਆ ਉੱਥੇ ਤੋਂ ਜਿਵੇਂ ਕੀ ਅੱਠ ਅੱਠ ਜਿਵੇਂ ਕੀ ਪੰਜ ਸੌ ਦੇ ਸ਼ੂ ਸ਼ੂਜ਼ ਜੁੱਤੀ ਫੁੱਲਕਾਰੀ ਚੁੰਨੀ ਅੱਠ ਹਜ਼ਾਰ ਦੀ ਅੱਛੀ ਅੱਛੀ ਮਿਲ ਜਾਂਦੀ ਹੈ ਤੁਸੀਂ ਜਿਵੇਂ ਜੋ ਤੁਸੀਂ ਚਾਹੁੰਦੇ ਹੋ ਉਦੋਂ ਮਿਲ ਜਾਂਦੀ ਹੈ ਹੱਥ ਬਣਾਏ ਵੀ ਮਿਲਦੇ ਉੱਥੇ ਜਿ ਜਿਹੜੇ ਹੱਥ 'ਚ ਰੇਡੀਮੇਟ ਆ ਆਰਟੀਫਿਸ਼ਲ ਹੁੰਦੇ ਆ ਨਾ ਉੱਥੋਂ ਮਿਲ ਜਾਂਦੇ ਆ ਨਵਾਂਸ਼ਹਿਰ ਤੋਂ ਫੁੱਲਕਾਰੀ ਦੁਕਾਨ ਹਾਂਜੀ ਹਾਂਜੀ ਹੈਗੀ ਹੈ ਇੱਥੇ ਪਾਸ ਮੇ ਹੀ ਹੈਗੀ ਹੈ ਨਵਾਂਸ਼ਹਿਰ 'ਚ ਹੀ ਹੈਗੀ ਹੈ ਨਹੀਂ ਉੱਥੇ ਤੋਂ ਸਸਤੀ ਹਾਂਜੀ ਉੱਥੇ ਸਸਤੀ ਮਿਲ ਜਾਉਗੀ ਮਹਿੰਗੀ ਵੀ ਹੈਗੀ ਸਸਤੀ ਵੀ ਹੈਗੀ ਉੱਥੇ ਤਾਂ ਜਿਹੋ ਜਿਹੀ ਤੁਸੀਂ ਜਾ ਉਹ ਤਾਂ ਤੁਹਾਡੇ 'ਤੇ ਡੀਪੈਂਡ ਕਰਦਾ ਜੀ ਤੁਸੀਂ ਕਿੰਨਾ ਖ਼ਰਚ ਦਿਉਂਗੇ ਕਿੰਨਾ ਖ਼ਰਚ ਨਹੀਂ ਕਰੋਗੇ ਹਾਂਜੀ ਜੁੱਤੀ ਤੂ ਮਿਲ ਹਾਂਜੀ ਜੁੱਤੀ ਚ ਹਜ਼ਾਰ 'ਚ ਆ ਹੀ ਜਾਉਗੀ ਫੁੱਲਕਾਰੀ ਚੁੰਨੀ ਹਜ਼ਾਰ ਤੋਂ ਜ਼ਿਆਦਾ ਆਉਂਗੀ ਸ਼ਾਇਦ ਹਾਂਜੀ ਜੇ ਜੇ ਬਹੁਤ ਸਾਰੇ ਕਲਰ ਦੀ ਮਿਲੇ ਰੈੱਡ ਬਲੂਅ ਬਲੈਕ ਸਕਿੰਨ ਵੀ ਜੋ ਜਿਹੜੇ ਕਲਰ ਥੋ ਥੋਆਡੇ ਮਨਪਸੰਦ ਹੋਣੇ ਉਹ ਉਹੋ ਜਿਹੇ ਮਿਲ ਜਾਣਗੇ ਕਲਰ ਉੱਥੇ ਹਾਂਜੀ ਕਢਾਈ ਵਾਲੇ ਵੀ ਮਿਲ ਜਾਣਗੇ ਜੀ ਕਿਆ ਵੋ ਵੀ ਹੱਥ ਨਾਲ ਬਣਾਏ ਸੁੰਦਰ ਸੁੰਦਰ ਮੋਤੀਆਂ ਜੋ ਉੱਪਰ ਹੁੰਦੀ ਹੈ ਨਾ ਉਹਦੀ ਦੇ ਵਰਗੀ ਜੁੱਤੀ ਮਿਲਦੀ ਹੈ ਉੱਥੇ ਹਾਂਜੀ ਅਰ ਹੋਰ ਜੀ ਅਨੰਦਪੁਰ ਜੋ ਹੱਥ ਜੇ ਨਾਲ ਬਣਾਏ ਜੇ ਮੋਤੀਆਂ ਜੋ ਹੁੰਦੇ ਨਾ ਉਹਨਾਂ ਦੀ ਪ੍ਰਾਈਜ਼ ਵੀ ਥੋੜ੍ਹੇ ਜ਼ਿਆਦਾ ਹੁੰਦੇ ਹੈ ਜਿਵੇਂ ਕਿ ਪੰਜ ਹਜ਼ਾਰ ਪੰਚ ਐਸੇ ਹਾਂਜੀ ਐਸੇ ਹੁੰਦੇ